ਸਤਿ ਸ਼੍ਰੀ ਅਕਾਲ ਸਰ ਮੈਂ ਕਾਰਤਿਕ ਬੋਲ ਰਿਹਾ ਪਠਾਨਕੋਟ ਤੋਂ ਸਰ ਸਾਡੇ ਸਾਡੇ ਪਠਾਨਕੋਟ ਵਿੱਚ ਸਾਰੇ ਧਰਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਕਿਉਂਕਿ ਸਾਰੇ ਧਰਮ ਇੱਕ ਬਰਾਬਰ ਹੀ ਹੁੰਦੇ ਹਨ ਔਰ ਸਾਰੇ ਧਰਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ ਔਰ ਜਿਵੇਂ ਕਿ ਸਾਡੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਾਨੂੰ ਛੁਆ ਛੂਤ ਤੋਂ ਮੁਕਤ ਕਰਵਾਇਆ ਸੀ ਔਰ ਅਸੀਂ ਇਹ ਧਰਮ ਬਣਾ ਕੇ ਫਿਰ ਤੋਂ ਉਹ ਹੀ ਪ੍ਰਕਿਰਿਆ ਫਿਰ ਜਾਰੀ ਕਰਨੇ ਹਾਂ ਪਰ ਸਾਨੂੰ ਇੱਦਾਂ ਨਹੀਂ ਕਰਨੇ ਚਾਹੀਦਾ ਸਾਨੂੰ ਆਪਣੇ ਧਰਮ ਦੀ ਪਾਲਣਾ ਕਰਨੀ ਚਾਹੀਦੀ ਹੈ ਸਾਨੂੰ ਭੁਲਣ ਆਪਣਾ ਧਰਮ ਨਹੀਂ ਭੁੱਲਣਾ ਚਾਹੀਦਾ ਕਦੇ ਵੀ ਸਾਡੇ ਸਾਡੇ ਧਰਮ ਹਿੰਦੂ ਭਰਾ ਔਰ ਸਿੱਖ ਭਰਾ ਸਾਰੇ ਹੀ ਆਪਸ ਵਿੱਚ ਮਿਲ ਕੇ ਰਹਿਣੇ ਚਾਹੀਦੇ ਹਨ ਸਾਡੇ ਸਾਡੇ ਪਿੰਡ ਵਿੱਚ ਗੁਰਦੁਆਰਾ ਮਸਜਿਦ ਚਰਚ ਔਰ ਗੁ ਮੰਦਿਰ ਵੀ ਬਣੇ ਹੋਏ ਹਨ ਜਿਸ ਨਾਲ ਕਿ ਸਾਡੇ ਹਿੰਦੂ ਹਿੰਦੂ ਮੰਦਿਰ ਵੀ ਜਾਂਦੇ ਹਨ ਔਰ ਗੁਰਦੁਆਰੇ ਵੀ ਜਾਂਦੇ ਹਨ ਔਰ ਸਰਦਾਰ ਸਰਦਾਰ ਜੀ ਸਾਡੇ ਮੰਦਿਰ ਵੀ ਆਉਂਦੇ ਹਨ ਔਰ ਗੁਰਦੁਆਰੇ ਵੀ ਜਾਂਦੇ ਹਨ ਉਸ ਤਰ੍ਹਾਂ ਹੀ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਇਸ ਨਾਲ ਕਿ ਆਪਸੀ ਆਪਸੀ ਪਿਆਰ ਵੱਧਦਾ ਹੈ ਔਰ ਕਿਸੇ ਨੂੰ ਵੀ ਕੁਝ ਗਲਤ ਨਹੀਂ ਬੋਲਣਾ ਚਾਹੀਦਾ ਸਾਨੂੰ ਹਮੇਸ਼ਾ ਇੱਕ ਦੂਜੇ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਨਾਲ ਸਾਡੇ ਦੇਸ਼ ਦਾ ਭਵਿੱਖ ਸੁਧਰ ਸਕਦਾ ਹੈ ਅਗਰ ਅਸੀਂ ਐਵੇਂ ਹੀ ਇੱਕ ਦੂਜੇ ਨੂੰ ਧਰਮ ਦੇ ਨਾਂ 'ਤੇ ਇ ਕਰਦੇ ਰਹਾਂਗੇ ਬਦਨਾਮ ਕਰਦੇ ਰਹਾਂਗੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਇਸ ਲਈ ਆਪਣੇ ਭਰਾਵਾਂ ਨੂੰ ਅੱਗੇ ਤੋਂ ਅੱਗੇ ਵਧਾਓ ਔਰ ਸਾਰੇ ਧਰਮਾਂ ਦੀ ਪਾਲਣਾ ਕਰੋ ਕਿਉਂਕਿ ਸਾਰੇ ਧਰਮ ਇੱਕ ਬਰਾਬਰ ਹੀ ਹੁੰਦੇ ਹਨ ਸਬ ਸਭ ਕਾ ਮਾਲਿਕ ਏਕ ਹੈ ਥੈਂਕ ਯੂ